ਮੇਰੀ ਹੁਣ ਤੱਕ ਦੀ ਸਭ ਤੋਂ ਸੁੰਦਰ ਯਾਤਰਾ ਗੋਆ ਦੀ ਹੈ ਜੋ ਮੈਂ ਹਰ ਸਾਲ ਚਾਹੁੰਦੀ ਹਾਂ ਕਿ ਮੈਂ ਗੋਆ 'ਤੇ ਜਾਵਾਂ ਮੈਨੂੰ ਸਮੁੰਦਰ ਦੇ ਕੋਲ ਬੈਠਣਾ ਸਮੁੰਦਰਾਂ ਦੀ ਲਹਿਰਾਂ ਦੇ ਨਾਲ ਖੇਡਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਉੱਥੇ ਸਵੇਰੇ ਉੱਠ ਕੇ ਸੂਰਜ ਚੜ੍ਹਨਾ ਅਤੇ ਸ਼ਾਮ ਦੇ ਵੇਲੇ ਸੂਰਜ ਡੁੱਬਣ ਦਾ ਸਮੇਂ ਸਭ ਤੋਂ ਹੀ ਸੋਹਣਾ ਹੁੰਦਾ ਐਨਾ ਸ਼ਾਂਤ ਐਨਾ ਪੀਸਫੁਲ ਜਗ੍ਹਾ ਹੁੰਦੀ ਹੈ ਕਿ ਮਤਲਬ ਉੱਥੇ ਜਾ ਕੇ ਸਾਰੇ ਦੁੱਖ ਦਰਦ ਅਸੀਂ ਭੁੱਲ ਸਕਦੇ ਹਾਂ ਸਮੁੰਦਰਾਂ ਦੀ ਲਹਿਰਾਂ ਦੇ ਵਿੱਚ ਖੇਡਣਾ ਸਭ ਤੋਂ ਹੀ ਵਧੀਆ ਲੱਗਦਾ ਅਤੇ ਮੇਰੇ ਵਾਸਤੇ ਤੋਂ ਸਮੁੰਦਰ ਦੇ ਕੋਲ ਵੀ ਰਹਿਣਾ ਸਭ ਤੋਂ ਸੁੰਦਰ ਯਾਤਰਾ ਮੰਨੀ ਜਾਂਦੀ ਹੈ ਮੇਰੇ ਵਾਸਤੇ